ਅੱਜ ਕੱਲ੍ਹ ਹਸਪਤਾਲਾਂ ਵਿੱਚ ਕਾਫ਼ੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਸਫਾਈ ਦੇ ਮਾਮਲੇ ਵਿੱਚ ਅਸੀਂ ਵੇਖੀਏ ਤਾਂ ਹਸਪਤਾਲਾਂ ਵਿੱਚ ਸਾਨੂੰ ਪਹਿਲਾਂ ਨਾਲੋਂ ਕਾਫ਼ੀ ਸਫਾਈ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਉੱਥੋਂ ਦੇ ਐਡਮਿਟ ਪੇਸ਼ੈਂਟਸ ਨੂੰ ਗੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹ ਸਾਫ਼ ਸੁਥਰਿਆਂ ਕਮਰਿਆਂ ਵਿੱਚ ਰਹਿੰਦੇ ਹਨ ਜਿਸ ਅੱਜ ਕੱਲ੍ਹ ਤਾਂ ਸਰਕਾਰ ਨੇ ਪੇਸ਼ੈਟਸ ਨੂੰ ਪੈਸੇ ਜਿਸ ਨਾਲ ਜਿਹੜੇ ਕਿ ਵੱਡੇ ਉਮਰ ਦੇ ਹਨ ਉਹਨਾਂ ਦਾ ਹੈਲਥ ਇਨਸ਼ੋਰੈਂਸ ਰਾਹੀਂ ਉਹਨਾਂ ਦੇ ਪੈਸੇ ਘਟਾ ਦਿੱਤੇ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਅ ਘੱਟ ਪੈਸੇ ਦਿੱਤੇ ਜਾਂਦੇ ਹਨ ਜਿਹੜੇ ਉਹਨਾਂ ਦਾ ਇਲਾਜ ਹੈ ਉਸ ਦੇ ਨਾਲ ਉਹ ਅੱਧ ਪੈਸੇ ਉਹਨਾਂ ਨੂੰ ਦੇਣੇ ਪੈਂਦੇ ਹਨ ਇਸ ਲਈ ਹੈਲਥ ਇੰਸ਼ੋਰੈਂਸ ਕਾਫ਼ੀ ਵਧੀਆ ਤਰੀਕੇ ਨਾਲ ਲੋਕਾਂ ਲਈ ਵਧੀਆ ਤਰੀਕੇ ਨਾਲ ਸਾਹਮਣੇ ਆਇਆ ਹੈ ਹੈਲਥ ਇਨਸ਼ੋਰੈਂਸ ਸਰਕਾਰ ਨੇ ਇਹ ਕਰਕੇ ਬਹੁਤ ਵਧੀਆ ਕੀਤਾ ਹੈ ਸਰਕਾਰ ਜਿਹੜਾ ਉਹਨਾਂ ਨੇ ਸਰਕਾਰ ਨੇ ਪੈਸੇ ਕ ਘੱਟ ਕਰਕੇ ਉਹ ਪੈਸੇ ਲੈਂਦੀ ਹੈ ਇਹ ਬਹੁਤ ਹੀ ਵਧੀਆ ਤਰੀਕਾ ਹੈ ਹੈਲਥ ਇਨਸ਼ੋਰੈਂਸ ਰਾਹੀਂ ਬ ਲੋਕਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਨੇ ਚਨ ਪੈਂਦੇ ਹਨ ਜਿਹੜੇ ਗਰੀਬ ਹਨ ਉਹਨਾਂ ਨੂੰ ਇਲਾਜ ਲਈ ਘੱਟ ਪੈਸੇ ਦੇਣੇ ਚਾਹੀਦੇ ਹਨ ਤਾਂ ਇਹ ਸਰਕਾਰ ਨੇ ਬਹੁਤ ਵਧੀਆ ਕੀਤਾ ਹੈਲਸ਼ਿਨ ਹੈਲਥ ਇਨਸ਼ੋਰੈਂਸ ਇੱਕ ਬਹੁਤ ਵਧੀਆ ਚੀਜ਼ ਹੈ ਹਸਪਤਾਲ ਅੱਗੇ ਨਾਲੋਂ ਕਾਫ਼ੀ ਵਧੀਆ ਨ ਹਨ ਹੁਣ ਕੈਂਨਟੀਨਾਂ ਵੀ ਹਸਪਤਾਲਾਂ ਵਿੱਚ ਬਣੀਆਂ ਹਨ ਜਿਸ ਨਾਲ ਉੱਥੇ ਫੂਡ ਵਗੈਰਾ ਉਹਨਾਂ ਨੂੰ ਉਪਲੱਬਧ ਹੁੰਦਾ ਹੈ ਉਹਨਾਂ ਨੂੰ ਦਵਾਈਆਂ ਵੀ ਉੱਥੇ ਦਿੱਤੀਆਂ ਜਾਂਦੀਆਂ ਹਨ ਹਰੇਕ ਤਰ੍ਹਾਂ ਦੀ ਉੱਥੇ ਸੁਵਿਧਾ ਹੁੰਦੀ ਹੈ ਲੋਕਾਂ ਦੇ ਲਈ ਜਿਸ ਨਾਲ ਉਹਨਾਂ ਨੂੰ ਕੋਈ ਜ਼ਿਆਦਾ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ